ਮੈਂ ਜਦੋਂ ਆਪਣੀ ਗਾਇਕੀ ਲਈ ਸ ਗੀਤ ਚੁਣਦਾ ਹਾਂ ਤਾਂ ਮੈਂ ਇਹ ਵੇਖਦਾ ਹਾਂ ਕਿ ਉਹ ਸਮਾਜ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦੇਣਗੇ ਮੈਂ ਉਨ੍ਹਾਂ ਦੀ ਗੀਤਾਂ ਦੀ ਚੋਣ ਨਹੀਂ ਕਰਦਾ ਜਿਹੜੇ ਗੀਤ ਸਮਾਜ ਨੂੰ ਅਸ਼ਲੀਲਤਾ ਵੱਲ ਲੈ ਕੇ ਜਾਂਦੇ ਹੋਣ ਸਮਾਜ ਨੂੰ ਸੇਧ ਨਾ ਦਿੰਦੇ ਹੋਣ ਸਗੋਂ ਮੇਰੇ ਗੀਤਾਂ ਦੀ ਚੋਣ ਵਿੱਚ ਉਨ੍ਹਾਂ ਸ਼ਬਦਾਂ ਨੂੰ ਵੇਖਿਆ ਜਾਂਦਾ ਹੈ ਕਿ ਉਹ ਗੀਤ ਕਿਹੋ ਜਿਹੇ ਹਨ ਕਿ ਮੇਰੇ ਸਮਾਜ ਨੂੰ ਉਹ ਸਮਝ ਆਉਣਗੇ ਕਿ ਮੇਰਾ ਸਮਾਜ ਉਨ੍ਹਾਂ ਨੂੰ ਅਕਸੈਪਟ ਕਰੇਗਾ ਜੇਕਰ ਮੇਰਾ ਸਮਾਜ ਉਨ੍ਹਾਂ ਨੂੰ ਅਕਸੈਪਟ ਨਹੀਂ ਕਰਦਾ ਤਾਂ ਮੈਂ ਉਨ੍ਹਾਂ ਗੀਤਾਂ ਨੂੰ ਦੂਰ ਰੱਖਦਾ ਹਾਂ ਮੈਂ ਉਨ੍ਹਾਂ ਸਰੋਤਿਆਂ ਦੇ ਥਾਂ ਤੇ ਖੜ੍ਹਾ ਹੋ ਕੇ ਵੇਖਦਾ ਹਾਂ ਕਿ ਜਿਹੜੇ ਮ ਮੇਰੀ ਥਾਂ 'ਤੇ ਹਨ ਅਤੇ ਮੈਂ ਉਨ੍ਹਾਂ ਲਈ ਗੀਤ ਗਾ ਰਿਹਾ ਹੋਵਾਂ ਅਤੇ ਮੈਂ ਉਨ੍ਹਾਂ ਗੀਤਾਂ ਨੂੰ ਹੀ ਰਿਕਾਰਡ ਕਰਦਾ ਹਾਂ ਅਤੇ ਓਸ ਤਰ੍ਹਾਂ ਰਿਕਾਰਡ ਕਰਦਾ ਹਾਂ ਉਨ੍ਹਾਂ ਸੰਗੀਤ ਲਹਿਰਾਂ ਵਿੱਚ ਰਿਕਾਰਡ ਕਰਦਾ ਹਾਂ ਜੋ ਮੇਰੀ ਸੰਸਕ੍ਰਿਤੀ ਵਿੱਚ ਲੋੜੀਂਦੇ ਹਨ